ਹੈਲੋ ਮੈਮ ਸਤਿ ਸ਼੍ਰੀ ਅਕਾਲ ਮੈਮ ਤੁਸੀਂ ਡਾਕਟਰ ਗੀਤਾਂਜਲੀ ਠਾਕੁਰ ਜੀ ਬੋਲ ਰਹੇ ਹੋ ਮੈਮ ਮੇਰੇ ਨਾ ਪ੍ਰੈਗਨੈਂਸੀ ਜਿੱਦਾਂ ਵਨ ਥਰਡ ਮੰਥ ਚਲਦਾ ਪਿਆ ਮੈਂ ਨਾ ਤੁਹਾਨੂੰ ਆਪਣੇ ਬਾਰੇ ਕੁਝ ਗੱਲਾਂ ਪੁੱਛਣੀ ਚਾਹੁੰਦੀ ਹਾਂ ਤੁਸੀਂ ਮੈਨੂੰ ਦੱਸ ਸਕਦੇ ਹਾਂਜੀ ਜਿੱਦਾਂ ਨਾ ਮੈਮ ਮੈਨੂੰ ਤੁਸੀਂ ਦੱਸੋ ਨਾ ਜਿੱਦਾਂ ਇਹਦੇ ਵਿੱਚ ਨਾ ਜ਼ਿਆਦਾ ਕੰਮ ਭਾਰ ਬੋਝ ਭਾਰ ਦਾ ਕੰਮ ਨਹੀਂ ਕਰਨਾ ਤੁਸੀਂ ਦੱਸੋ ਮੈਨੂੰ ਕਿਆ ਕਿਆ ਕੰਮ ਕਰਨਾ ਨਹੀਂ ਚਾਹੀਦਾ ਇਹਦੇ ਵਿੱਚ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਅੱਛਾ ਜੀ ਹਾਂਜੀ ਮੈਮ ਮੇਰੇ ਪੇਨ ਵਗੈਰਾ ਵੀ ਬਹੁਤ ਹੁੰਦੀ ਹੈ ਜਿੱਦਾਂ ਦੋ ਕੁ ਦਿਨ ਬਾਅਦ ਪੇਨ ਹੋਣ ਲੱਗ ਜਾਂਦੀ ਆ ਉਹਦੇ ਬਾਰੇ ਕੁਛ ਦੱਸ ਦੋ ਮੈਂ ਚੈੱਕਅਪ ਵਗੈਰਾ ਵੀ ਕਰਾਉਂਦੀ ਆਪਣਾ ਅਤੇ ਮੈਂ ਚੈਕਅਪ ਲਈ ਤੁਹਾਡੇ ਕੋਲ ਕਦੋਂ ਆ ਸਕਦੀ ਹਾਂਜੀ ਹਾਂਜੀ ਹਾਂਜੀ ਜੀ ਹਾਂਜੀ ਮੈਂ ਕਰਵਾਏ ਆ ਮੇਰੇ ਹਾਂਜੀ ਅਤੇ ਹਾਂਜੀ ਹਾਂਜੀ ਮੈਮ ਆਇਰਨ ਵੀ ਚੱਲਦਾ ਮੇਰਾ ਕੈਲਸ਼ੀਅਮ ਵੀ ਚੱਲਦਾ ਮੈਮ ਮੇਰੇ 'ਚ ਨਾ ਹਾਂਜੀ ਹਾਂਜੀ ਹਾਂਜੀ ਮੈਮ ਸਮਝਦੇ ਹਾਂਜੀ ਔਰ ਮਤਲਬ ਜਿੱਦਾਂ ਨਾ ਮੇਰੇ ਪੇਨ ਵਗੈਰਾ ਹੁੰਦੀ ਹੈ ਤਾਂ ਮੈਂ ਜਿੱਦਾਂ ਇੰਨੀ ਦੂਰ ਕਦੇ ਆ ਨਹੀਂ ਸਕਦੀ ਹੈ ਜਿੱਦਾਂ ਮਤਲਬ ਫਿਰ ਮੈਂ ਆਪਣੇ ਨਾਲ ਦੀ ਡਿਸਪੈਂਸਰੀ ਵਗੈਰਾ 'ਤੇ ਜਾ ਕੇ ਚੈੱਕਅਪ ਕਰਾ ਸਕਦੀ ਹਾਂ

ਓਕੇ ਮੈਮ ਜੀ

ਹਾਂਜੀ ਸਬਜ਼ੀ 'ਤੇ ਮੈਮ ਐਂ ਵੀ ਦੱਸ ਦਿਉ ਕਿਹੜੀ ਸਬਜ਼ੀ ਮੈਨੂੰ ਮਤਲਬ ਜ਼ਿਆਦਾ ਖਾਣੀ ਚਾਹੀਦੀ ਹੈ ਮਤਲਬ ਕਈ ਗਰਮ ਵੀ ਸਬਜ਼ੀਆਂ ਹੁੰਦੀਆਂ ਨਾ ਜਿੱਦਾਂ ਬੈਂਗਣ ਵਗੈਰਾ ਕਰੇਲੇ ਵਗੈਰਾ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਔਰ ਮੈਮ ਥੈਂਕ ਯੂ ਮੈਮ ਜੇ ਮੈਨੂੰ ਜ਼ਿਆਦਾ ਦਿੱਕਤ ਆਈ ਮੈਂ ਤੁਹਾਡੇ ਨਾਲ ਫਿਰ ਗੱਲ ਕਰਾਂਗੀ ਧੰਨਵਾਦ ਮੈਮ ਜੀ ਠੀਕ ਹੈ ਓਕੇ ਮੈਮ ਥੈਂਕ ਯੂ